ਕੰ ਇਸ ਲਈ ਸਾਡਾ ਭਾਈਚਾਰਾ ਵੀ ਪੰਜਾਬੀ ਹੈ ਅਤੇ ਸ ਅਸੀਂ ਰਹਿਣ ਵਾਲੇ ਹੀ ਬੋਲਦੇ ਹੀ ਪੰਜਾਬੀਆਂ 'ਚ ਸਾਡੀ ਮਾਂ ਬੋਲੀ ਹੀ ਪੰਜਾਬੀ ਹੈ ਅਸੀਂ ਮੀਡੀਆ ਵਿੱਚ ਅਸੀਂ ਇੱਕ ਦੂਜੇ ਅਸੀਂ ਸ ਅੱਜ ਕੱਲ੍ਹ ਸੰਸਾਰ ਵਿੱਚ ਹਾਂ ਸਕੂਟਰੀਆਂ ਗੱਡੀਆਂ ਕਾਰਾਂ ਤੱਕ ਅਸੀਂ ਜਾ ਸਕਦੇ ਹਾਂ ਕਿਉਂਕਿ ਅਸੀਂ ਰੇਡੀਓ ਟੈਲੀਵਿਜ਼ਨ 'ਤੇ ਹਾਂ ਪ੍ਰਿੰਟ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਾਂ ਕਿਉਂਕਿ ਅਸੀਂ ਟੀ ਵੀ ਵਿੱਚ ਹਾਂ ਪੰਜਾਬੀ ਹੀ ਫਿਲਮਾਂ ਫਿਲਮਾਂ ਖ ਉਹ ਕਹਿੰਦੇ ਨੇ ਖਬਰਾਂ ਅਤੇ ਨਾਟਕ ਵਗੈਰਾ ਵੀ ਦੇਖ ਸਕਦੇ ਹਾਂ ਅਤੇ ਅਸੀਂ ਰੇਡੀਓ 'ਚ ਹਾਂ ਜਿਹੜੇ ਕੋਈ ਲੋਕ ਬਜ਼ੁਰਗ ਸੁਣਦੇ ਅਤੇ ਲਿਖ ਸਕਦੇ ਆ ਪੰਜਾਬੀ ਬੋਲ ਸਕਦੇ ਹਨ ਅਤੇ ਉਹ ਰੇਡੀਓ ਦੀ ਵਰਤੋਂ ਕਰਦੇ ਹਨ ਕਿਉਂਕਿ ਰੇਡੀਓ ਵਿੱਚ ਗਾਣੇ ਵਗੈਰਾ ਹਾਂ ਸੁਣਦੇ ਹਨ ਅਤੇ ਖਬਰਾਂ ਵੀ ਸੁਣਦੀਆਂ ਹਨ ਪ੍ਰਿੰਟ ਮਤਲਬ ਪ੍ਰਿੰਟ ਛਾਪ ਕੇ ਜੇ ਕੋਈ ਛਾਪ ਕੇ ਖਬਰ ਆਉਂਦੀ ਹੋਵੇ ਤਾਂ ਅਖਬਾਰਾਂ ਵਿੱਚ ਜਿਵੇਂ ਕਿ ਉਹ ਸਾਡੇ ਤੱਕ ਪ ਪਹੁੰਚਦੀ ਹੈ ਕਿਉਂਕਿ ਅਸੀਂ ਪੰਜਾਬੀ ਭਾਸ਼ਾ ਵਿੱਚ ਹੀ ਲਿਖ ਸਕਦੇ ਹਾਂ ਅਤੇ ਅਸੀਂ ਉਹਨਾਂ ਨੂੰ ਸੁਣ ਸਕਦੇ ਹਾਂ ਕਿਉਂਕਿ ਸਾਡੇ ਸਾਡੇ ਪੰਜਾਬ ਵਿੱਚ ਹੀ ਹਾਂ ਰੇਡੀਓ ਟੈਲੀਵਿਜ਼ਨ ਅਤੇ ਮੀਡੀਆ ਤੱਕ ਅਤੇ ਦੂਰ ਦੂਰ ਤੱਕ ਹਾਂ ਫੈਲ ਚੁੱਕੀ ਕਿਉਂਕਿ ਅਸੀਂ ਅੱਜ ਕੱਲ੍ਹ ਤਾਂ ਬਹੁਤ ਕੁਛ ਹੀ ਚੱਲ ਪਿਆ ਕਿਉਂਕਿ ਸਕੂਟਰੀਆਂ ਮੋਟਰ ਸਾਈਕਲ ਕਾਰਾ 'ਤੇ ਅਸੀਂ ਦੂਰ ਤੱਕ ਹੀ ਜਾ ਕੇ ਖਬਰਾਂ ਹੀ ਪ੍ਰ ਕਰ ਸਕਦੇ ਹਾਂ ਸੁਣ ਵੀ ਸਕਦੇ ਹਾਂ ਅਤੇ ਨਨ ਸੁਣ ਵੀ ਸਕਦੇ ਜਿਹੜੇ ਕਿ ਸਾਡੇ ਘਰ ਬੈਠੇ ਬਜ਼ੁਰਗ ਹੀ ਨੇ ਉਹ ਰੇਡਿਓ ਦੁਆਰਾ ਜਾਂ ਟੈਲੀਵਿਜ਼ਨ ਰਾਹੀਂ ਮੀਡੀਆ ਦੁਆਰਾ ਹੀ ਸੁਣ ਸਕਦੇ ਹਨ ਅਤੇ ਪ੍ਰਿੰਟਗ ਅਖਬਾਰ ਜੇ ਸਾਡੇ ਘਰ ਆਉਂਦਾ ਹੈ ਤਾਂ ਉਹਦੇ ਵਿੱਚ ਅਸੀਂ ਪੜ੍ਹ ਵੀ ਸਕਦੇ ਹਾਂ ਅਤੇ ਲੋਕਾਂ ਦੀਆਂ ਆਮ ਤੌਰ 'ਤੇ ਹਰ ਰੋਜ਼ ਦੀਆਂ ਖਬਰਾਂ ਹੀ ਨਿਊਜ਼ ਹੀ ਸੁਣ ਸਕਦੇ ਹਾਂ ਕਿਉਂਕਿ ਅਸੀਂ ਅੱਜ ਕੱਲ੍ਹ ਹੋ ਰਹੇ ਪੰਜਾਬ ਵਿੱਚ ਕੀ ਕੁਛ ਹੋ ਰਿਹਾ ਪੰਜਾਬੀ ਵਿੱਚ ਉਹ ਘਰ ਬੈਠੇ ਹੀ ਸੁਣ ਸਕਦੇ ਹਾਂ